ਸਤਿ ਸ਼੍ਰੀ ਅਕਾਲ ਜੀ ਇਹ ਯਕੀਨ ਬਣਾਉਣ ਲਈ ਕਿ ਅਸੀਂ ਕੀ ਉਪਾਅ ਕਰਦੇ ਹਾਂ ਨਵੇਂ ਬੱਚੇ ਵਾਸਤੇ ਜਨਮ ਸਵੱਛ ਵਾਤਾਵਰਨ ਵਾਸਤੇ ਅਸੀਂ ਬੱਚਾ ਬਿਮਾਰ ਨਾ ਹੋਵੇ ਨਵਾਂ ਜੰਮਿਆ ਇਸ ਕਰਕੇ ਅਸੀਂ ਸਵੱਛ ਹਰ ਚੀਜ਼ ਅਸੀਂ ਸਾਫ਼ ਸੁਥਰੀ ਰੱਖਦੇ ਹਾਂ ਬਿਸਤਰਾ ਸਾਫ਼ ਰੱਖਦੇ ਹਾਂ ਉਹਨਾਂ ਦੇ ਹਰ ਚੀਜ਼ ਸਾਫ਼ ਸਫਾਈ ਰੱਖਦੇ ਹਾਂ ਆਪਣਾ ਵਾਰ ਵਾਰ ਸਾਨੂੰ ਹੱਥ ਧੋ ਕੇ ਬੱਚੇ ਦੇ ਕੋਲ ਜਾਣਾ ਚਾਹੀਦਾ ਸਾਨੂੰ ਬਹੁਤ ਜ਼ਿਆਦਾ ਸਫਾਈ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਨਵੇਂ ਬੱਚੇ ਜਨਮੇ ਨੂੰ ਕੋਈ ਵੀ ਕੀਟਾਣੂ ਨਾ ਕੋਈ ਵੀ ਹਾਂ ਨੁਕਸਾਨ ਨਾ ਕਰ ਸਕੇ ਅਤੇ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਉਹਨਾਂ ਦੇ ਕੱਪੜਿਆਂ ਦੀ ਸਾਫ਼ ਸਫਾਈ ਉਹਨਾਂ ਦਾ ਬਿਸਤਰਾ ਸਾਫ਼ ਹੋਣਾ ਚਾਹੀਦਾ ਜ਼ਿਆਦਾ ਜਣੇ ਉਹਨਾਂ ਦੇ ਕੋਲ ਨਾ ਜਾਣ ਫਿਰ ਕੀਟਾਣੂ ਨਾ ਉਹਨਾਂ ਨੂੰ ਜ਼ਿਆਦਾ ਪ੍ਰ ਹੋਰ ਕੋਈ ਵੀ ਬਿਮਾਰੀ ਨਾ ਹੋਵੇ ਉਹਨਾਂ ਨੂੰ ਇਸ ਕਰਕੇ ਅਸੀਂ ਹਰ ਚੀਜ਼ ਦਾ ਬਹੁਤ ਸਫਾਈ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖਦੇ ਹਾਂ ਕਿ ਨਵੇਂ ਬੱਚੇ ਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਪ੍ਰੋਬਲਮ ਨਾ ਹੋਵੇ ਕਿ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਕੋਲ ਨੁਕਸਾਨ ਘੱਟ ਤੋਂ ਘੱਟ ਜਾਣਾ ਚਾਹੀਦਾ ਕਿ ਕੋਈ ਵੀ ਬਿਮਾਰੀ ਜਾਂ ਕੋਈ ਕਿਸੇ ਦੇ ਕੀਟਾਣੂ ਉਹਨਾਂ ਨੂੰ ਨਾ ਹੋ ਜਾਣ ਇਸ ਕਰਕੇ ਸਾਨੂੰ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਮਾਂ ਅਤੇ ਬੱਚੇ ਦਾ ਦੋਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਇਸ ਕਰਕੇ ਅਸੀਂ ਪੂਰੀ ਕੋਸ਼ਿਸ਼ ਇਹ ਹੋ ਹੀ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਕੱਪੜੇ ਸਾਫ਼ ਰੱਖੀਏ ਉਹਨਾਂ ਦਾ ਹਰ ਚੀਜ਼ ਸਾਫ਼ ਸਫਾਈ ਦਾ ਧਿਆਨ ਰੱਖੀਏ ਹੱਥ ਧੋ ਕੇ ਉਹਨਾਂ ਦੇ ਕੋਲ ਜਾਈਏ ਅਸੀਂ ਕਿ ਉਹਨਾਂ ਨੂੰ ਕੋਈ ਵੀ ਕੀਟਾਣੂ ਨਾ ਇੱਦਾਂ ਹੋਵੇ ਕੀਟਾਣੂ ਦੇ ਨਾਲ ਕੋਈ ਬਿਮਾਰੀ ਨਾ ਹੋਵੇ ਕਿ ਅਸੀਂ ਹਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ